ਸਤਿ ਸ਼੍ਰੀ ਅਕਾਲ ਜੀ ਹਾਂਜੀ ਵਧੀਆ ਠੀਕ ਹ ਜੀ

ਹਾਂਜੀ ਅਸੀਂ ਨਾ ਸੋਨਾ ਲੈਣਾ ਸੀਗਾ ਸੋਨਾ ਬਣਾਉਣਾ ਸੀ ਅਸੀਂ ਤੇ ਆਪਣੇ ਕੋਲ ਕਿਸ ਕਿਸ ਤਰ੍ਹਾਂ ਦਾ ਹੈਗਾ ਸੋਨਾ ਚਲੋ ਤੁਸੀਂ ਚੋਵੀ ਵਾਲਾ ਦੇ ਦਵੋ ਤੇ ਤੁਹਾਨੂੰ ਉਹਦੇ ਵਿੱਚ ਨੈਕਲਸ ਵਗੈਰਾ ਵੀ ਚਾਹੀਦੇ ਨੇ ਟੋਪਸ ਵਗੈਰਾ ਕੜਾ ਮੁੰਦਰੀ ਕਿੱਟੀ ਸੈੱਟ ਵਗੈਰਾ ਜੀ ਅਸੀਂ ਇਹ ਸਾਰਾ ਕੁਝ ਬਣਵਾਉਣਾ ਜੀ ਹਾਂਜੀ ਹਾਂਜੀ ਸਾਡੇ ਨਾ ਬੇਟਾ ਜੀ ਦੀ ਮੈਰਿਜ ਹ ਤੇ ਮੈਂ ਆਪਣੀ ਬਹੂ ਵਾਸਤੇ ਤੇ ਬੇਟੇ ਵਾਸਤੇ ਬਣਾਣਾ ਏ ਹਾਂਜੀ ਤੇ ਹਾਂਜੀ ਹਾਂਜੀ ਨਹੀਂ ਨਹੀਂ ਸਾਨੂੰ ਨਹੀਂ ਜੀ ਸਾਨੂੰ ਨਵੇਂ ਡਿਜਾਇਨ ਵਾਲਾ ਚਾਹੀਦਾ ਹ ਤੇ ਤੁਸੀਂ ਦੋਨੋਂ ਹੀ ਵਿਖਾ ਦਿਓ ਜਿਹੜੇ ਸਾਨੂੰ ਵਧੀਆ ਲੱਗਾ ਦੋਨਾਂ ਚੋਂ ਅਸੀਂ ਫਿਰ ਉਹੀ ਲਵਾਂਗੇ ਜਿਹੜਾ ਸਾਨੂੰ ਵਧੀਆ ਲੱਗਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਸੀਂ ਫਿਰ ਆਪਣੀ ਬਹੂ ਵਾਸਤੇ ਲੈਣਾ ਨਾ ਉਹ ਸਾਨੂੰ ਵਧੀਆ ਚ ਚਾਹੀਦਾ ਜਿਹਦੇ ਵਿੱਚ ਪੂਰਾ ਸੈੱਟ ਬਣਿਆ ਹੋਵੇ ਟੋਪਸ ਵਗੈਰਾ ਕਾਂਟੇ ਟਿੱਕਾ ਮੁੰਦਰੀ ਵਿੱਚ ਸਾਡਾ ਸੈੱਟ ਆਉਂਦਾ ਏ ਤੇ ਜਿਹੜਾ ਹਾਂਜੀ ਤੇ ਸਾਡੀ ਬੇਟੀ ਵਾਸਤੇ ਸੈਟ ਚਾਹੀਦਾ ਏ ਠੀਕ ਹ ਕੋਈ ਗੱਲ ਨਹੀਂ ਤੇ ਸਾਨੂੰ ਮੁੰਦਰੀਆਂ ਵੀ ਚਾਹੀਦੀਆਂ ਨੇ ਦੋ ਤਿੰਨ ਤੇ ਕੜੇ ਵੀ ਚਾਹੀਦੇ ਨੇ ਹਾਂਜੀ ਕੋਈ ਗੱਲ ਨੀ ਅਸੀਂ ਵੇਖ ਕੇ ਫਿਰ ਤੁਹਾਨੂੰ ਪਸੰਦ ਕਰਕੇ ਦੱਸ ਦਿੰਦੇ ਆਂ ਤੇ ਸਾਨੂੰ ਕਿਸ ਤਰ੍ਹਾਂ ਦੇ ਚਾਹੀਦੇ ਨੇ ਤੇ ਸਾਨੂੰ ਇਨਾ ਚ ਹਾਂਜੀ ਹਾਂਜੀ ਤੇ ਸਾਨੂੰ ਨਹੀਂ ਸਾਨੂੰ ਮਿਡੀਅਮ ਜਿਹਾ ਚਾਹੀਦਾ ਜਿਵੇਂ ਟਿੱਕੇ ਦਾ ਤੋਂ ਸੈੱਟ ਮੀਡੀਅਮ 'ਚ ਆ ਜਾਂਦਾ ਜਿਆਦਾ ਵੱਡਾ ਨਹੀਂ ਅਸੀਂ ਲੈਣਾ ਤੇ ਇੱਕ ਉਹ ਟਿੱਕਾ ਲੈਣਾ ਜਿਹੜਾ ਸਾਈਡ ਟਿੱਕਾ ਹੁੰਦਾ ਏ ਹਾਂਜੀ ਹਾਂਜੀ ਇੱਕ ਨਾਲ ਅਸੀਂ ਮੰਗਲਸੂਤਰ ਸੋਨੇ ਦਾ ਲੈਣਾ ਏ ਹਾਂਜੀ ਹਾਂਜੀ ਨਹੀਂ ਉਹ ਤਾਂ ਮੈਂ ਲਵਾਂਗੀ ਮੈਂ ਕਹਿ ਰਹੀ ਸੀ ਪਹਿਲਾਂ ਆਪਣੀ ਬਹੂ ਤੇ ਬੇਟੇ ਵਾਸਤੇ ਲੈ ਲਵਾਂ ਤੇ ਉਹਨਾਂ ਦੇ ਸਹੁਰੇ ਪਰਿਵਾਰ ਵਾਸਤੇ ਨਹੀਂ ਸਾਨੂੰ ਆਹ ਸਾਨੂੰ ਆਹ ਵਾਲਾ ਸੈੱਟ ਹਾਂਜੀ ਹਾਂਜੀ ਸਾਨੂੰ ਆਹ ਵਾਲਾ ਸੈਟ ਬਹੁਤ ਪਸੰਦ ਹ ਤੁਸੀਂ ਆਹ ਵਾਲਾ ਸੈਟ ਸਾਨੂੰ ਦੇ ਦਵੋ ਤੇ ਇਕ ਆਹ ਵਾਲਾ ਹਾਂਜੀ ਕੋਈ ਗੱਲ ਨਹੀਂ ਤੁਸੀਂ ਵੇਟ ਕਰਕੇ ਦੱਸ ਦੋ ਕਿੰਨੇ ਦਾ ਏ ਹਾਂਜੀ ਠੀਕ ਐ ਜੀ ਤੇ ਇੱਕ ਹਾਂਜੀ ਇੱਕ ਸਾਨੂੰ ਇਹ ਵਾਲਾ ਕਿੱਟੀ ਸੈੱਟ ਹਾਂਜੀ ਹਾਂਜੀ ਆਹ ਵਾਲਾ ਪਸੰਦ ਆ ਗਿਆ ਕਿੱਟੀ ਸੈੱਟ ਇਹ ਸਾਨੂੰ ਦੱਸ ਦੋ ਕਿੰਨੇ ਦਾ ਏ ਅੱਛਾ ਠੀਕ ਹ ਤੇ ਦੋ ਮੁੰਦਰੀਆਂ ਦੇ ਦੋ ਸਾਨੂੰ ਹਾਂਜੀ ਠੀਕ ਹ ਆਹ ਦੋ ਮੁੰਦਰੀਆਂ ਦੇ ਦੋ ਸਾਨੂੰ ਤੇ ਹਾਂਜੀ ਇੱਕ ਕੜਾ ਦੇ ਦੋ ਇਹਨਾਂ ਤਿੰਨਾਂ ਦਾ ਦੱਸੋ ਕੀ ਬਣਦਾ ਸਾਨੂੰ ਠੀਕ ਏ ਤੇ ਇੱਕ ਸਾਨੂੰ ਪੰਜੇਬਾਂ ਵੀ ਵਿਖਾ ਦਵੋ ਜਿੱਦਾਂ ਕਿਹੜੀਆਂ ਕਿਹੜੀਆਂ ਨੇ ਹਾਂਜੀ ਦੋਨੇ ਵਿਖਾ ਦੋ ਭਾਰੀ ਵਾਲੀਆਂ ਵੀ ਤੇ ਹਾਂਜੀ ਹਾਂਜੀ ਭਾਰੀਆ ਪੰਜੇਬਾਂ ਵਿਖਾ ਦਿਓ ਸਾਨੂੰ

ਠੀਕ ਹ ਜੀ ਤੇ ਇੱਕ ਤੁਸੀਂ ਹੁਣ ਮੇਰੇ ਵਾਸਤੇ ਸੈਟ ਵਿਖਾ ਦਿਓ ਹਾਂਜੀ ਹਾਂਜੀ ਆਹ ਵਾਲਾ ਸੈੱਟ ਦੇ ਦੇ ਤੁਸੀਂ ਸਾਨੂੰ ਹਾਂਜੀ ਹਾਂਜੀ ਹਾਂਜੀ ਇਹ ਸਾਰਾ ਹੁਣ ਕਰਕੇ ਤੁਸੀਂ ਮੈਨੂੰ ਪੇਟ ਪੇਮੈਂਟ ਦੱਸ ਦੋ ਫਿਰ ਮੈਂ ਤੁਹਾਨੂੰ ਸਾਰੀ ਪੇਮੈਂਟ ਕਲੀਅਰ ਕਰਵਾਦਾ ਠੀਕ ਹ ਜੀ ਓਕੇ ਮੈਂ ਤੁਹਾਨੂੰ ਪੇਮੈਂਟ ਕਰ ਦਿੰਨੀ ਆ ਓਕੇ ਜੀ